ਤਿਉਹਾਰ ਭਾਰਤ ਇੱਕ ਬਹੁਤ ਹੀ ਤਿਉਹਾਰ ਭਰਿਆ ਦੇਸ਼ ਹੈ ਭਾਰਤ ਦੇ ਹਰ ਹਿੱਸੇ ਵਿੱਚ ਅਲੱਗ ਅਲੱਗ ਵਿੱਚ ਅਲੱਗ ਅਲੱਗ ਤਿਉਹਾਰ ਮਨਾਏ ਜਾਂਦੇ ਹਨ ਅਤੇ ਭਾਰਤ ਵਿੱਚ ਹਰ ਸਾ ਹਰ ਮਹੀਨੇ ਵਿੱਚ ਕਈ ਕਈ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਮੈਂ ਪੰਜਾਬ ਤੋਂ ਹਾਂ ਪੰਜਾਬ ਦੇ ਵਿੱਚ ਜੇ ਖਾਸ ਤਿਉਹਾਰ ਹਨ ਜਿਵੇਂ ਵਿਸਾਖੀ ਲੋਹੜੀ ਦੁਸਹਿਰਾ ਦਿਵਾਲੀ ਕਰਵਾ ਚੌਥ ਇੱਦਾਂ ਇਵੇਂ ਦੇ ਕਾਫੀ ਤਿਉਹਾਰ ਹਨ ਜੋ ਪੰਜਾਬ ਵਿੱਚ ਮਨਾਏ ਜਾਂਦੇ ਹਨ ਅਤੇ ਆਪਾਂ ਬਹੁਤ ਹੀ ਖੁਸ਼ੀ ਨਾਲ ਆਪਣੀ ਘਰ ਵਿੱਚ ਮਨਾਉਂਦੇ ਹਨ ਤਿਉਹਾਰ ਮਨਾਉਂਦੇ ਹਾਂ ਤਾਂ ਦਾ ਮਤਲਬ ਉਹ ਤੋਂ ਸਿੱਧਾ ਸਾਨੂੰ ਪਤਾ ਲੱਗਦਾ ਕਿ ਘਰ ਵਿੱਚ ਖੁਸ਼ੀਆਂ ਹੁੰਦੀਆਂ ਅਤੇ ਮਿਠਾਈਆਂ ਬਣਾਈਆਂ ਜਾਂਦੀਆਂ ਹਨ ਅਤੇ ਘਰ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਪਕਾਈਆਂ ਜਾਂਦੀਆਂ ਹਨ ਘਰ ਦੇ ਵਿੱਚ ਅ ਸ ਤਿਉਹਾਰ ਕੋਈ ਵੀ ਤਿਉਹਾਰ ਹੁੰਦਾ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਸਾਨੂੰ ਕਿ ਹੁਣ ਮੰਮੀ ਘਰ ਵਿੱਚ ਅ ਮਿਠਾਈ ਬਣਾਊਂਗੇ ਅਤੇ ਆਪਾਂ ਖਾਊਂਗੇ ਅਤੇ ਘਰ ਵਿੱਚ ਮੰਮੀ ਅਲੱਗ ਅਲੱਗ ਤਰ੍ਹਾਂ ਦੀਆਂ ਮਿਠਾਈਆਂ ਬਣਾਉਂਦੀਆਂ ਰਸ ਮਲਾਈ ਗੁਲਾਬ ਜਾਮੁਨ ਰਸਗੁੱਲਾ ਜਲੇਬੀਆਂ ਜਿਹਨਾਂ ਵਿੱਚੋਂ ਕੁਛ ਮੈਨੂੰ ਪਸੰਦ ਹਨ ਅਤੇ ਕੁਛ ਮੇਰੇ ਭਰਾ ਨੂੰ ਪਸੰਦ ਹਨ ਅਤੇ ਉਹ ਤੋਂ ਬਾਅਦ ਮਿਠਾਈਆਂ ਦੇ ਨਾਲ ਨਾਲ ਕਾਫੀ ਸਾਰੀ ਨਮਕੀਨ ਚੀਜ਼ਾਂ ਵੀ ਘਰ ਵਿੱਚ ਬਣਾਈਆਂ ਜਾਂਦੀਆਂ ਪਕੌੜੇ ਕਚੌਰੀਆਂ ਅਤੇ ਹੋਰ ਅਲੱਗ ਅਲੱਗ ਤਰ੍ਹਾਂ ਦੀਆਂ ਅਤੇ ਸ ਜਦੋਂ ਮਿਠਾਈਆਂ ਬਣਾਈਆਂ ਜਾਂਦੀਆਂ ਹਨ ਉਦੋਂ ਆਪਾਂ ਕਾਫੀ ਚਾਵਾਂ ਨਾਲ ਮਿਠਾਈਆਂ ਖਾਂਦੇ ਹਨ ਤਿਉਹਾਰਾਂ ਦਾ ਮਹੱਤਵ ਹੀ ਅ ਮਿਠਾਈਆਂ ਅਤੇ ਖੁਸ਼ੀਆਂ ਮਨਾਉਣ ਨਾਲ ਹੈ ਅਗਰ ਤਿਉਹਾਰਾਂ ਵਿੱਚ ਮਿਠਾਈਆਂ ਨਾ ਹੋਵੇ ਤਾਂ ਉਹ ਉਨੀਂ ਖੁਸ਼ੀ ਨਹੀਂ ਹੁੰਦੀ ਅਤੇ ਉਨਾਂ ਮਤਲਬ ਮਜ਼ਾ ਵੀ ਨਹੀਂ ਆਉਂਦਾ ਅਤੇ ਤਿਉਹਾਰ ਵਿੱਚ ਜੋ ਮੈਨੂੰ ਮੰਮੀ ਮੇਰੀ ਮਿਠਾਈ ਬਣਾਉਂਦੀ ਹੈ ਸਭ ਤੋਂ ਜ਼ਿਆਦਾ ਪਸੰਦ ਰਸ ਮਲਾਈ ਹੈ ਅਤੇ ਨਮਕੀਨ ਵਿੱਚ ਮੈਨੂੰ ਪਕੌੜੇ ਬਹੁਤ ਪਸੰਦ ਹਨ ਅਤੇ ਮੇਰੇ ਭਰਾ ਨੂੰ ਰ ਰਸਗੁੱਲਾ ਪਸੰਦ ਹੈ ਅਤੇ ਉਹਨੂੰ ਨਮਕੀਨ ਵਿੱਚ ਕੋਈ ਇੱਦਾਂ ਦੀ ਚੀਜ਼ ਨਹੀਂ ਪਸੰਦ ਏ ਉਹ ਜ਼ਿਆਦਾ ਮਿਠਾਈ ਹੀ ਖਾਣਾ ਪਸੰਦ ਕਰਦਾ ਹੈ ਤਿਉਹਾਰ ਤਿਉਹਾਰ ਅਤੇ ਮਿਠਾਈਆਂ ਦਾ ਦੋਨਾਂ ਦਾ ਬਹੁਤ ਹੀ ਗਹਿਰਾ ਰਿਸ਼ਤਾ ਹੈ ਤਿਉਹਾਰਾਂ ਦੇ ਨਾਲ ਹੀ ਮਿਠਾਈਆਂ ਹਨ ਅਤੇ ਜੋ ਸਾਨੂੰ ਖੁਸ਼ੀ ਦਿੰਦੀਆਂ ਹਨ